ਖੇਤੀਬਾੜੀ ਵਿੱਚ ਟੈਕਨੋਲੇਜੀ ਨੇ ਸਾਡੀ ਬਹੁਤ ਮਦਦ ਕੀਤੀ ਹੈ ਕੋਈ ਸਮਾਂ ਹੁੰਦਾ ਸੀ ਜਦੋਂ ਬਲਦਾਂ ਨਾਲ ਵਾਹੀ ਜਾਂਦੀ ਸੀ ਪਰ ਸਮਾਂ ਇਹੋ ਜਿਹਾ ਬਦਲਿਆ ਵੀ ਟਰੈਕਟਰ ਨ ਦੀ ਖੋਜ ਹੋਈ ਪਹਿਲਾਂ ਸਾਰੇ ਦਿਨ ਵਿੱਚ ਦੋ ਚਾਰ ਕਿੱਲੇ ਹੀ ਵਾਹ ਹੁੰਦੇ ਪਰ ਹੁਣ ਇੱਕ ਦਿਨ ਵਿੱਚ ਹੀ ਇੱਕ ਟਰੈਕਟਰ ਨਾਲ ਵੀਹ ਕਿੱਲੇ ਵੀ ਵਾਹ ਹੋ ਜਾਂਦੇ ਹੈ ਇਸ ਤੋਂ ਇਲਾਵਾ ਪਹਿਲਾਂ ਬੀਜ ਬਿਜਣ ਲਈ ਕੇਰਨੇ ਪੈਂਦੇ ਜਾਂ ਛਿੱਟਾ ਦੇਣਾ ਪੈਂਦਾ ਪਰ ਹੁਣ ਟੈਕਨੋਲੇਜੀ ਦੀ ਬਦੌਲਤ ਮਸ਼ੀਨਾਂ ਇਹ ਸਾਰਾ ਕੰਮ ਕਰਦੀਆਂ ਪੱਠੇ ਵੱਢਣ ਲਈ ਦਾਤੀ ਵਰਤੀ ਜਾਂਦੀ ਸੀ ਪਰ ਹੁਣ ਇਹ ਕੰਮ ਵੱਡੀਆਂ ਮਸ਼ੀਨਾਂ ਕਰਦੀਆਂ ਪਹਿਲਾਂ ਕਣਕ ਵੀ ਹੱਥੀਂ ਵੱਢੀ ਜਾਂਦੀ ਜਿਸ ਲਈ ਕਈ ਬੰਦਿਆਂ ਦੀ ਜ਼ਰੂਰਤ ਪੈਂਦੀ ਪਰ ਹੁਣ ਕਪੈਨਾ ਆ ਗਈਆਂ ਜੋ ਕਈ ਬੰਦਿਆਂ ਦਾ ਕੰਮ ਇਕੱਲੀਆਂ ਕਰ ਦਿੰਦੀਆਂ ਜੋ ਪਸ਼ੂ ਪਾਲਣ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਵੀ ਬਹੁਤ ਬਦਲਾਅ ਆ ਗਿਆ ਕਿਸੇ ਸਮੇਂ ਪਸ਼ੂ ਹੱਥਾਂ ਨਾਲ ਚੋਏ ਜਾਂਦੇ ਪਰ ਹੁਣ ਇਹ ਕੰਮ ਵੀ ਮਸ਼ੀਨਾਂ ਦੁਆਰਾ ਕੀਤਾ ਜਾਂਦਾ